ਪੰਜਾਬੀ ਭਾਸ਼ਾ ਵਿੱਚ ਕੁਝ ਵਾਕ ਅਤੇ ਮੁਹਾਵਰੇ ਆਮ ਘਰਾਂ ਵਿੱਚ ਵਰਤੇ ਜਾਂਦੇ ਹਨ ਜਿਵੇਂ ਉੱਲੂ ਬੋਲਣਾ ਅੱਜ ਕੱਲ੍ਹ ਦੇ ਸਾਰੇ ਬੱਚੇ ਚਾਰ ਅੱਖਰ ਪੜ੍ਹ ਕੇ ਵਿਦੇਸ਼ਾਂ ਵਿੱਚ ਜਾਣ ਲੱਗਦੇ ਹਨ ਅਤੇ ਪੰਜਾਬ ਦੇ ਸਾਰੇ ਘਰਾਂ ਵਿੱਚ ਤਕਰੀਬਨ ਜਿਵੇਂ ਉੱਲੂ ਬੋਲਦੇ ਨੇ ਇਸ ਤਰ੍ਹਾਂ ਲੱਗਦਾ ਤਾਂ ਅਸੀਂ ਇਹ ਮੁਹਾਵਰਾ ਵਰਤਦੇ ਹਾਂ ਵੀ ਇਹ ਤਾਂ ਉਹੀ ਗੱਲ ਹੈ ਵੀ ਸਾਰੇ ਘਰਾਂ ਵਿੱਚ ਉੱਲੂ ਬੋਲਣ ਲੱਗ ਪਏ ਹਨ ਅਤੇ ਇੱਕ ਮੁਹਾਵਰਾ ਇਹ ਵੀ ਆਮ ਵਰਤਿਆ ਜਾਂਦਾ ਆਪਣੇ ਘਰਾਂ 'ਚ ਜਿਵੇਂ ਉੱਨੀ ਇੱਕੀ ਦਾ ਫਰਕ ਹੋਣਾ ਜਦੋਂ ਦਸਵੀਂ ਦਾ ਰਿਜਲਟ ਆਇਆ ਤਾਂ ਮੇਰੇ ਬੱਚੇ ਦੇ ਨੰਬਰ ਜਿਹੜਾ ਫਸਟ ਆਇਆ ਸੀ ਉਹਦੇ ਨਾਲੋਂ ਕੁਛ ਪੁਆਇੰਟ ਘੱਟ ਸੀ ਅਤੇ ਉਹ ਉਦਾਸ ਜਿਹਾ ਹੋ ਗਿਆ ਅਤੇ ਮੈਂ ਉਹਨੂੰ ਕਿਹਾ ਕਿ ਚੱਲ ਕੋਈ ਗੱਲ ਨਹੀਂ ਵੀ ਥੋੜ੍ਹਾ ਹੀ ਫਰਕ ਆ ਹੈਗਾ ਉੱਨੀ ਇੱਕੀ ਦਾ ਫਰਕ ਹੀ ਹੈ ਇਸ ਤਰ੍ਹਾਂ ਦੇ ਮੁਹਾਵਰੇ ਆਮ ਸਾਡੇ ਰੋਜ਼ ਘਰਾਂ ਵਿੱਚ ਵਰਤੇ ਜਾਂਦੇ ਨੇ ਅਤੇ ਉਹ ਹੋਰ ਵੀ ਕਈ ਮੁਹਾਵਰੇ ਅਜਿਹੇ ਕਿਹੜਾ ਸੀਗਾ ਅੱਤ ਚੱਕਣੀ ਅੱਜ ਕੱਲ੍ਹ ਦੇ ਬੱਚੇ ਥੋੜ੍ਹਾ ਬਹੁਤਾ ਪੜ੍ਹ ਕੇ ਅਤੇ ਅੱਤ ਚੱਕ ਲੈਂਦੇ ਇੱਕ ਦੂਜੇ ਦੇ ਮਗਰ ਲੱਗ ਕੇ ਵੀ ਸਾਨੂੰ ਵਿਦੇਸ਼ਾਂ ਨੂੰ ਭੇਜੋ ਜਿਵੇਂ ਮਰਜ਼ੀ ਕਰੋ ਜ਼ਮੀਨਾਂ ਵੇਚੋ ਕਰੋ ਉਹ ਕਰੋ ਅਤੇ ਫਿਰ ਆਪਾਂ ਕਹਿੰਦੇ ਹਾਂ ਵੀ ਇਸ ਨੇ ਤਾਂ ਅੱਤ ਚੱਕ ਲਈ ਈਨ ਮੰਨਣਾ ਅੱਜ